ਸ਼ਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਅੱਜ ਆਪਣੇ ਪਰਿਵਾਰ ਅਤੇ ਦੋਸਤਾਂ ਬਾਰੇ ਦੱਸਣਾ ਚਾਹੁੰਦੀ ਹਾਂ ਮੇਰੇ ਪਰਿਵਾਰ ਵਿੱਚ ਮੇਰੇ ਮੰਮੀ ਪਾਪਾ ਦਾਦਾ ਦਾਦੀ ਚਾਚਾ ਚਾਚੀ ਦੋ ਭਰਾ ਅਤੇ ਇੱਕ ਭੈਣ ਰਹਿੰਦੇ ਹਨ ਅਸੀਂ ਸਾਰੇ ਇਕੱਠੇ ਰਹਿੰਦੇ ਹਾਂ ਅਸੀਂ ਰਲ਼ ਮਿਲ ਕੇ ਰਹਿੰਦੇ ਹਾਂ ਮੇਰੀ ਚਾਚੀ ਅਤੇ ਦਾਦੀ ਅਤੇ ਮੰਮਾ ਆਪਸ ਵਿੱਚ ਬਹੁਤ ਹੀ ਪਿਆਰ ਨਾਲ਼ ਰਹਿੰਦੇ ਹਨ ਅਤੇ ਮੈਨੂੰ ਉਹਨਾਂ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਮੈਨੂੰ ਵੀ ਸਭ ਨਾਲ਼ ਪਿਆਰ ਨਾਲ਼ ਰਹਿਣਾ ਚਾਹੀਦਾ ਹੈ ਮੇਰੇ ਦਾਦੀ ਜੀ ਰੋਜ਼ ਪਾਠ ਕਰਦੇ ਹਨ ਅਤੇ ਵਾਕ ਦੇ ਵਿੱਚ ਜੋ ਵੀ ਸਿੱਖਿਆ ਹੁੰਦੀ ਹੈ ਉਹ ਮੈਨੂੰ ਰੋਜ਼ ਦੱਸਦੇ ਹਨ ਅਤੇ ਪਾਠ ਕਰਨ ਦੀ ਮੱਤ ਬਖਸ਼ਦੇ ਹਨ ਮੇਰੇ ਭੈਣ ਭਰਾ ਸਕੂਲ ਜਾਂਦੇ ਹਨ ਅਤੇ ਉਹ ਰੋਜ਼ ਹੀ ਵਧੀਆ ਪੜ੍ਹਦੇ ਹਨ ਅਤੇ ਮੇਰੇ ਦੋਸਤ ਜੋ ਕਿ ਸਹਿਪਾਠੀ ਮੇਰੇ ਨਾਲ਼ ਪੜ੍ਹਦੇ ਹਨ ਉਹ ਵੀ ਬੜੇ ਵਧੀਆ ਹਨ ਉਹ ਮੈਨੂੰ ਝੂਠ ਬੋਲਣ ਤੋਂ ਰੋਕਦੇ ਹਨ ਬੜਾ ਹੀ ਸਾਥ ਦਿੰਦੇ ਹਨ ਜਦੋਂ ਵੀ ਮੇਰੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਅਤੇ ਉਹ ਮੇਰੇ ਨਾਲ਼ ਖੜ੍ਹੇ ਹੁੰਦੇ ਹਨ ਅਤੇ ਮੇਰੇ ਦੋਸਤ ਬੜੇ ਹੀ ਚੰਗੇ ਹਨ ਬੜਾ ਮੈਨੂੰ ਪਿਆਰ ਕਰਦੇ ਹੈ ਅਤੇ ਗਲਤੀ ਹੋਣ 'ਤੇ ਮੈਨੂੰ ਰੋਕਦੇ ਹਨ ਅਤੇ ਚੰਗੀਆਂ ਗੱਲਾਂ ਵਿੱਚ ਮੇਰਾ ਸਾਥ ਦਿੰਦੇ ਹਨ ਧੰਨਵਾਦ